ਅੱਜ ਕੱਲ੍ਹ ਜਦੋਂ ਇਲੈਕਸ਼ਨ ਦਾ ਸਮੇਂ ਚੱਲਦਾ ਹੈ ਤਾਂ ਕੁਛ ਰਾਜਨੀਤਿਕ ਨੇਤਾ ਜਿਹੜੇ ਹੁੰਦੇ ਨੇ ਉਹ ਕਾਫ਼ੀ ਤਨਾਅ ਪੈਦਾ ਕੁਝ ਲੋਕ ਹੁੰਦੇ ਨੇ ਜੋ ਤਨਾਅ ਪੈਦਾ ਕਰਦੇ ਨੇ ਧਰਮ ਜਾਂ ਫਿਰ ਵਪਾਰ ਦੇ ਉੱਤੇ ਹੀ ਉਨ੍ਹਾਂ ਨੂੰ ਆਪਣਾ ਵੋਟ ਲੈਣ ਦੀ ਕੋਸ਼ਿਸ਼ ਕਰਦੇ ਨੇ ਜਿੱਦਾਂ ਕਿ ਅਸੀਂ ਉਦਾਹਰਨ ਵੀ ਲੈ ਸਕਦੇ ਹਾਂ ਜਿੱਦਾਂ ਕਿ ਅੱਜ ਇਲੈਕਸ਼ਨ ਹੋ ਰਹੇ ਨੇ ਤਾਂ ਕੁਛ ਦਿਨ ਪਹਿਲਾਂ ਕੁਛ ਲੋਕ ਦੇਖਣਗੇ ਅਗਰ ਤਾਂ ਉਹਨਾਂ ਨੂੰ ਲੱਗੇਗਾ ਕਿ ਉਹ ਸ ਸਾਡੇ ਹੀ ਧਰਮ ਦੇ ਨੇ ਤਾਂ ਉਹਨਾਂ ਦੀ ਵੋਟ ਲੈਣ ਦੀ ਕੋਸ਼ਿਸ਼ ਕਰੇਗਾ ਉਹਨਾਂ ਨੂੰ ਬੋਲੇਗਾ ਕੇ ਤੁਸੀ ਤਾਂ ਸਾਡੇ ਹੀ ਧਰਮ ਦੇ ਹੋ ਤੁਸੀ ਸਾਡੇ ਭਾਈ ਹੋ ਗਏ ਜਾਂ ਭੈਣ ਹੋ ਗਏ ਤੁਸੀਂ ਸਾਨੂੰ ਹੀ ਵੋਟ ਦਓ ਤਾਂ ਜੋ ਅਸੀਂ ਜਿੱਤ ਸਕੀਏ ਇੱਦਾਂ ਕਰਕੇ ਉਹ ਆਪਣੇ ਧਰਮ ਦੇ ਨਾਮ ਉੱਤੇ ਵੀ ਅਪਣਾ ਵੋਟ ਲੈ ਲੈਂਦੇ ਨੇ ਅਤੇ ਵਪਾਰ ਦਾ ਵੀ ਇੱਕ ਸਾਧਨ ਹੈਗਾ ਉਹ ਤਾਂ ਪੈਸੇ ਦੇ ਕੇ ਵੀ ਵੋਟ ਲੈਣ ਦੀ ਕੋਸ਼ਿਸ਼ ਕਰਦੇ ਨੇ ਖਰੀਦਣ ਦੀ ਵੀ ਕੋਸ਼ਿਸ਼ ਕਰਦੇ ਨੇ ਲੋਕਾਂ ਨੂੰ ਇਹ ਕਈ ਜਗ੍ਹਾ ਹੁੰਦਾ ਹੈ ਕਈ ਜਗ੍ਹਾ ਨਹੀਂ ਹੁੰਦੀ ਕਈ ਜਿਹੜੇ ਨੇਤਾ ਹੁੰਦੇ ਉਹ ਇਮਾਨਦਾਰ ਹੁੰਦੇ ਨੇ ਉਹ ਸੋਚਦੇ ਨੇ ਕਿ ਜੋ ਸਾਨੂੰ ਜਿੰਨ੍ਹਾਂ ਨੂੰ ਅਸੀਂ ਵਧੀਆ ਲੱਗਾਂਗੇ ਤਾਂ ਉਹ ਸਾਨੂੰ ਵੋਟ ਦੇਣਗੇ ਪਰ ਇੱਦਾਂ ਦਾ ਨਹੀਂ ਕਰਨਾ ਚਾਹੀਦਾ ਸਾਨੂੰ ਪੈਸੇ ਦੇ ਕੇ ਵੋਟ ਨਹੀਂ ਖਰਿਦਣਾ ਚਾਹਿਦਾ ਖਰੀਦਣਾ ਚਾਈਦਾ ਵੋਟ ਦੇਣ ਦਾ ਅਧਿਕਾਰ ਇਨਸਾਨ ਦਾ ਆਪਣਾ ਖੁਦ ਦਾ ਹੁੰਦਾ ਹੈ ਉਹ ਆਪਣੀ ਸੋਚ ਸਮਝ ਕੇ ਆਧਾਰ ਉੱਤੇ ਹੀ ਆਪਣਾ ਵੋਟ ਦੇ ਸਕਦਾ ਹੈ ਅਤੇ ਉਸਨੂੰ ਆਪਣੇ ਸਮਝ ਦੇ ਨਾਲ ਹੀ ਵੋਟ ਦੇਣਾ ਚਾਈਦਾ ਹੈ ਤਾਂ ਜੋ ਉਹਨਾਂ ਦੇ ਇਲਾਕੇ ਦਾ ਵਿਕਾਸ ਹੋਵੇ ਅਤੇ ਦੇਸ਼ ਦਾ ਵਿਕਾਸ ਹੋਵੇ